ਇਸ ਖੇਤਰ ਵਿੱਚ ਅਕਸਰ ਵੇਖੇ ਜਾਣ ਵਾਲੇ ਕੁਝ ਪੰਛੀ ਇਸ ਤਰ੍ਹਾਂ ਹਨ ਜਿਵੇਂ ਕਿ ਕਾਂ ਕਬੂਤਰ ਚਿੜੀਆਂ ਤੋਤੇ ਘੁੱਗੀਆਂ ਗਟਾਰਾ ਮੈਨਾ ਮੋਰ ਕੋਇਲ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਛੀ ਹਨ ਪਰ ਮੇਰੀ ਪਸੰਦੀਦਾ ਪੰਛੀ ਮੋਰ ਹੈ ਉਹ ਇਸ ਕਰਕੇ ਕਿਉਂਕਿ ਮੈਨੂੰ ਮੋਰ ਬਹੁਤ ਪਸੰਦ ਹੈ ਅਤੇ ਜਦੋਂ ਬਾਰਿਸ਼ ਆਉਂਦੀ ਹੈ ਤਾਂ ਉਹ ਆਪਣੇ ਖੰਭ ਫੈਲਾਉਂਦਾ ਹੈ ਅਤੇ ਜਦੋਂ ਉਹ ਖੰਭ ਫੈਲਾਉਂਦਾ ਹੈ ਤਾਂ ਇੱਕ ਬਹੁਤ ਵਧੀਆ ਦ੍ਰਿਸ਼ ਬਣਦਾ ਹੈ ਅਤੇ ਉਹ ਦ੍ਰਿਸ਼ ਮੈਨੂੰ ਬਹੁਤ ਪਸੰਦ ਹੈ ਅਤੇ ਇਹਦੇ ਬਹੁਤ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਇਹਦੇ ਇਹਦੇ ਖੰਭ ਜਿਹੜੇ ਨੇ ਇਹ ਇਹ ਹਰ ਜਗ੍ਹਾ ਵਰਤੇ ਜਾਂਦੇ ਨੇ ਘਰ ਵਿੱਚ ਰੱਖਦੇ ਨੇ ਲੋਕ ਅਤੇ ਇਹ ਸ਼ੁਭ ਮੰਨੇ ਜਾਂਦੇ ਨੇ ਕਿ ਘਰ ਵਿੱਚ ਰੱਖਣਾ ਸ਼ੁਭ ਹੁੰਦਾ ਆ ਅਤੇ ਇਹਨ ਇਹ ਦੇ ਖੰਭਾਂ ਨਾਲ ਆਪਾਂ ਹਵਾ ਵੀ ਝੱਲ ਸਕਦੇ ਹਾਂ ਅਤੇ ਇਹਦੇ ਇਹ ਇੱਕ ਰਾਸ਼ਟਰੀ ਪੰਛੀ ਹੈ